ਮੈਂ ਰਾਕੇਸ਼ ਸੁਜਾਨਪੁਰ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਤੁਹਾਡੀ ਟਰੈਵਲ ਏਜੰਸੀ ਜਿਸਦਾ ਨਾਮ ਸ਼ਿਵਾ ਟਰੈਵਲ ਏਜੰਸੀ ਹੈ ਤੁਹਾਡੀ ਵੈਬਸਾਈਟ ਤੋਂ ਮੈਂ ਰਾਤ ਇੱਕ ਕੈਬ ਲੱਭ ਰਹੀ ਸੀ ਅਤੇ ਮੈਨੂੰ ਪੰਜ ਸੀਟਰ ਗੱਡੀ ਚਾਹੀਦੀ ਸੀ ਜਿਸ ਵਿੱਚ ਮੈਂ ਆਪਣੇ ਪਰਿਵਾਰ ਨਾਲ ਮਿਨੀ ਗੋਆ ਘੁੰਮਣ ਜਾਣਾ ਚਾਹੁੰਦੀ ਸੀ ਤੁਹਾਡੀ ਵੈੱਬਸਾਈਟ ਅਤੇ ਕੰਪਨੀ ਦੁਆਰਾ ਮੈਨੂੰ ਵੱਖ ਵੱਖ ਕੈਬ ਵਿਖਾਈਆਂ ਗਈਆਂ ਜਿਸ ਵਿੱਚੋਂ ਮੈਂ ਆਪਣੀ ਬਜਟ ਦੇ ਹਿਸਾਬ ਨਾਲ ਇੱਕ ਕੈਬ ਬੁੱਕ ਕਰਵਾ ਲਈ ਅਤੇ ਉਸ ਕੈਬ ਦਾ ਨੰਬਰ ਅਤੇ ਵੱਖ ਵੱਖ ਡਿਟੇਲ ਅਤੇ ਡਰਾਈਵਰ ਦਾ ਨਾਮ ਮੇਰੇ ਵਟਸਐਪ ਗਰੁੱਪ ਦੇ ਵਿੱਚ ਆ ਗਿਆ ਡਰਾਈਵਰ ਦਾ ਫੋਨ ਨੰਬਰ ਵੀ ਉਪਲੱਬਧ ਸੀ ਜਦੋਂ ਮੈਂ ਕੈਬ ਬੁੱਕ ਕਰ ਰਹੀ ਸੀ ਤਾਂ ਉਹ ਉਸ ਸਮੇਂ ਮੈਂ ਉੱਥੇ ਸੇ ਸਵੇਰੇ ਅੱਠ ਵਜੇ ਦਾ ਟਾਈਮ ਪਾਇਆ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਚਾਰ ਨੰਬਰ ਪਿਕ ਆਪ ਕਰ ਲਿਆ ਜਾਵੇ ਅਤੇ ਮੈਂ ਤੁਹਾਨੂੰ ਹੁਣ ਇਸ ਸਬੰਧ ਵਿੱਚ ਕਾਲ ਕੀਤੀ ਹੈ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਲਗਭਗ ਅੱਧਾ ਘੰਟਾ ਹੋ ਗਿਆ ਡਰਾਈਵਰ ਦੀ ਵੇਟ ਕਰਦਿਆਂ ਉਹ ਅਜੇ ਤੱਕ ਨਹੀਂ ਪਹੁੰਚਿਆ ਜਿਸ ਦਾ ਨਾਮ ਰਮਨਦੀਪ ਸਿੰਘ ਹੈ ਉਹ ਸਾਡੇ ਕੋਲ ਨਹੀਂ ਚੁੱਕ ਰਿਹਾ ਨਾ ਹੀ ਵੋ ਵਾਪਿਸ ਕਾਲ ਕਰ ਰਿਹਾ ਹੈ ਅਤੇ ਮੈਂ ਮੈਸੇਜ ਵੀ ਭੇਜਿਆ ਹੈ ਪਰ ਕੋਈ ਰਿਸਪੋਂਸ ਨਹੀਂ ਆਇਆ ਤੁਹਾਡੀ ਐਪ ਦੇ ਵਿੱਚ ਮੇਰੀ ਕੈਬ ਜੋ ਕਿ ਬੁੱਕ ਕੀਤੀ ਸੀ ਉਸ ਦੀ ਚੈਕਿੰਗ ਵੀ ਨਹੀਂ ਹੋ ਰਹੀ ਮੈਂ ਤੁਹਾਨੂੰ ਇਹੀ ਕਹਿਣਾ ਚਾਹਾਂਗੀ ਕਿ ਜਲਦੀ ਤੋਂ ਜਲਦੀ ਚਾਰ ਨੰਬਰ ਇੱਕ ਨਵੀਂ ਕੈਬ ਅਤੇ ਨਵਾਂ ਡਰਾਈਵਰ ਭੇਜਿਆ ਜਾਵੇ ਜੋ ਸਾਨੂੰ ਜਲਦ ਤੋਂ ਜਲਦ ਮਿਨੀ ਗੋਆ ਪਹੁੰਚਾ ਦੇਵੇ ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗੀ ਅੱਗੇ ਤੋਂ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਸਮੇਂ ਸਿਰ ਹਰ ਡਰਾਈਵਰ ਨੂੰ ਆਪਣੇ ਟਾਈਮ ਦੇ ਉੱਤੇ ਆਉਣਾ ਚਾਹੀਦਾ ਹੈ ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਾ ਹੋਵੇ ਧੰਨਵਾਦ